ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਸਾਡੇ ਪਿੰਡ ਵਿੱਚ ਜ਼ਿਆਦਾ ਖੇਡ ਫੁੱਟਬਾਲ ਖੇਡਿਆ ਜਾਂਦਾ ਹੈ ਫੁੱਟਬਾਲ ਦੀ ਖੇਡ ਅਸੀਂ ਆਪਣੇ ਪਿੰਡ ਦੇ ਖੇਡ ਮੈਦਾਨ ਵਿੱਚ ਖੇਡਦੇ ਹਾਂ ਜਾ ਕੇ ਜਿਸ ਤਰ੍ਹਾਂ ਅਸੀਂ ਆਪਣੀ ਇਸ ਸਾਰੀ ਗਲੀ ਦੇ ਮੁੰਡੇ ਇਕੱਠੇ ਹੋ ਕੇ ਜਾਂ ਸਕੂਲ ਦੇ ਜਿਹੜੇ ਸਾਡੇ ਨਾਲ ਪੜ੍ਹਦੇ ਨੇ ਸਾਡੇ ਸਹਿਪਾਠੀ ਹੁੰਦੇ ਨੇ ਉਹਨਾਂ ਨੂੰ ਬੁਲਾ ਕੇ ਫਿਰ ਅਸੀਂ ਸਾਰੇ ਜਾਣੇ ਇਕੱਠੇ ਹੋ ਜਾਂਦੇ ਨੇ ਇੱਕ ਤਾਂ ਸਾਡਾ ਸਾਰਿਆਂ ਨਾਲ ਇੱਕ ਫਰੈਂਡ ਸਰਕਲ ਵਧੀਆ ਬਣਿਆ ਰਹਿੰਦਾ ਹੈ ਸਾਰਿਆਂ ਨੂੰ ਉੱਥੇ ਗੌਸਪ ਹੁੰਦੀਆਂ ਨੇ ਗੱਲਾਂ ਬਾਤਾਂ ਕਰ ਲੈਂਦੇ ਆ ਪਿੰਡ ਦੇ ਖੇਡ ਦੇ ਮੈਦਾਨ ਵਿੱਚ ਜਿਸ ਤਰ੍ਹਾਂ ਸਾਰਾ ਇੱਕ ਸਾਂਝੀ ਜਗ੍ਹਾ ਹੁੰਦੀ ਹੈ ਖੇਡ ਦਾ ਮੈਦਾਨ ਜਿਸ 'ਤੇ ਸ ਹਰ ਇੱਕ ਪ੍ਰਾਣੀ ਜਾ ਕੇ ਪਿੰਡ ਦਾ ਹਰ ਇੱਕ ਕੋਈ ਵੀ ਪਿੰਡ ਦਾ ਵਸਨੀਕ ਹੈ ਅਤੇ ਉਹ ਜਾ ਕੇ ਉੱਥੇ ਉਹ ਖੇਡ ਨੂੰ ਵੇਖਦਾ ਹੈ ਫਿਰ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਇਸ ਕਰਕੇ ਮੈਂ ਜ਼ਿਆਦਾ ਫੁੱਟਬਾਲ ਦੀ ਖੇਡ ਇਸ ਕਰਕੇ ਪਸੰਦ ਕਰਨਾ ਇਹਦੇ ਵਿੱਚ ਰਨਿੰਗ ਬਹੁਤ ਜ਼ਿਆਦਾ ਹੁੰਦੀ ਹੈ ਇਸ ਨਾਲ ਰਨਿੰਗ ਜ਼ਿਆਦਾ ਹੁੰਦੀ ਹੈ ਅਤੇ ਇੱਕ ਇਹਦੇ ਨਾਲ ਸਰੀਰ ਦੀ ਫਿਟਨੈੱਸ ਵਧੀਆ ਰਹਿੰਦੀ ਹੈ ਇਸ ਕਰਕੇ ਮੈਂ ਆਪਣੇ ਪਿੰਡ ਦੇ ਖੇਡ ਮੈਦਾਨ ਵਿੱਚ ਫੁੱਟਬਾਲ ਦੀ ਗੇਮ ਖੇਡਦਾ ਹਾਂ